ਪੰਜਾਬੀ ਇੱਕ ਬਹੁਤ ਹੀ ਪਿਆਰੀ ਅਤੇ ਮਿੱਠੀ ਭਾਸ਼ਾ ਹੈ ਇਸ ਦਾ ਹਰੇਕ ਸ਼ਬਦ ਮੇਰਾ ਮਨਭਾਉਂਦਾ ਹੈ ਜਿਨ੍ਹਾਂ ਵਿੱਚੋਂ ਕੁਝ ਮੇਰੇ ਮਨਭਾਉਂਦੇ ਸ਼ਬਦ ਹਨ ਜਿਵੇਂ ਕਿ ਤ੍ਰਿੰਞਣ ਗਿੱਧਾ ਮੁਟਿਆਰਾਂ ਗੱਭਰੂ ਅਤੇ ਪਿੰਡ ਮੈਂ ਪੰਜਾਬੀ ਬੁਲਾਰੇ ਹੋਣ 'ਤੇ ਮਾਣ ਮਹਿਸੂਸ ਕਰਦੀ ਹਾਂ ਪੰਜਾਬੀਅਤ ਨੂੰ ਆਪਣੇ ਸ਼ਬਦਾਂ ਰਾਹੀਂ ਜ਼ਿੰਦਾ ਰੱਖਣਾ ਮੇਰੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਪੰਜਾਬ ਅਤੇ ਪੰਜਾਬੀਅਤ ਭਾਰਤ ਦਾ ਅਨਿੱਖੜਵਾਂ ਅੰਗ ਹੈ